ਹਾਂਜੀ ਪੰਜਾਬੀ ਦੀਆਂ ਕਈ ਖੇਤਰੀ ਭਾਸ਼ਾਵਾਂ ਜਿਵੇਂ ਕਿ ਸਾਡੇ ਇੱਧਰ ਮੋਹਾਲੀ ਜ਼ਿਲ੍ਹੇ ਦੀ ਭਾਸ਼ਾ ਬਿਲਕੁਲ ਹੀ ਸਿੱਧੀ ਅਤੇ ਸਰਲ ਹੈ ਜਿਹਦੇ ਵਿੱਚ ਅਸੀਂ ਸੀ ਦੀ ਵਰਤੋਂ ਬਹੁਤ ਹੀ ਕਰਦੇ ਹਾਂ ਹਾਂਜੀ ਦੀ ਕਰਦੇ ਹਾਂ ਇਹ ਅਤੇ ਸਿੰਪਲ ਹੈ ਅਤੇ ਆਪਣੇ ਇੱਧਰ ਨਾਭੇ ਸ਼ਹਿਰ ਵੱਲ ਸੰਗਰੂਰ ਵੱਲ਼ ਚਲੇ ਜਾਓ ਇਹਨਾਂ ਦੀ ਬੋਲੀ ਥੋੜ੍ਹੀ ਜਿਹੀ ਕ ਆਪਾਂ ਨੂੰ ਅੱਡ ਲੱਗਦੀ ਹੈ ਜਿਵੇਂ ਕਿ ਸਾਡੇ ਬੋਲਣੇ ਦਾ ਅਤੇ ਉਹਨਾਂ ਦੇ ਬੋਲਣੇ ਦਾ ਫ਼ਰਕ ਐਗਾ ਅਸੀਂ ਕਹਿ ਦਿੰਦੇ ਅੱਛਿਆ ਉਹ ਕਹਿ ਦਿੰਦੇ ਅੱਸਿਆ ਅਤੇ ਸਾਡੇ ਇੱਧਰ ਕਹਿ ਦਿੰਦੇ ਐਗੇ ਵੀ ਐਂਵੇ ਆਪਣੇ ਬੋਲਦੇ ਐਂ ਕਿ ਛੋਲੇ ਉਹ ਕਹਿ ਦਿੰਦੇ ਸ਼ੌਲੇ ਅਤੇ ਜਿਵੇਂ ਕਿ ਆਪਾਂ ਪਿਆਜ ਕਹਿੰਦੇ ਉਹ ਗੰਢੇ ਕਹਿੰਦੇ ਹੈ ਫ਼ਰਕ ਤਾਂ ਹਰ ਖੇਤਰ ਦੀ ਬੋਲੀ ਦਾ ਅੱਡ ਅੱਡ ਹੁੰਦਾ ਹੈ ਜੀ ਅਤੇ ਹਾਂ ਆਪਾਂ ਨੂੰ ਅ ਹਰ ਬੋਲੀ ਦਾ ਆਦਰ ਮਾਣ ਵੀ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਆਪਣੀ ਬੋਲੀ ਹੈ ਪਰ ਬੋਲੀ ਪਿਆਰੀ ਬਹੁਤ ਲੱਗਦੀ ਹੈ ਅਤੇ ਆਪਾਂ ਨੂੰ ਥੋੜ੍ਹੀ ਸਿੱਖਣੇ ਵਿੱਚ ਦਿੱਕਤ ਵੀ ਜ਼ਰੂਰ ਆਉਂਦੀ ਹੈ ਪਰ ਇਨਸਾਨ ਨੂੰ ਬੋਲੀ ਸਿੱਖਣੀ ਵੀ ਚਾਹੀਦੀ ਹੈ ਅਤੇ ਬੋਲਣੀ ਵੀ ਚਾਹੀਦੀ ਹੈ ਕਿ ਆਪਾਂ ਨੂੰ ਕਦੇ ਵੀ ਆਪਾਂ ਕਿਤੇ ਵੀ ਇਹਨੂੰ ਵਰਤ ਸਕਦੇ ਹਾਂ ਅਤੇ ਹੁਣ ਐਗਾ ਜੀ ਪੰਜਾਬੀ ਦੀਆਂ ਬੋਲੀਆਂ ਇਹ ਕਹੇਂ ਜਿਵੇਂ ਮਾਝੇ ਦੀ ਬੋਲੀ ਅੱਡ ਹੈ ਦੋਆਬੇ ਦੀ ਅੱਡ ਹੈ ਜੀ ਠੀਕ ਹੈ ਨਾ ਅਤੇ ਹੁਣ ਇੱਧਰ ਆਪਾਂ ਅੰਬਰਸਰ ਚਲੇ ਜਾਵੇ ਇਹਨਾਂ ਦੀ ਬੋਲੀ ਐਗੀ ਇਹਨਾਂ ਦੀ ਵੀ ਅੱਡ ਹੈ ਆਪਣੇ ਨਾਲੋਂ ਅਤੇ ਆਪਾਂ ਜੇ ਇੱਧਰ ਦੀ ਗੱਲ ਕਰੀਏ ਵੀ ਆਪਣੇ ਮੋਹਾਲੀ ਦੀ ਅਤੇ ਸਾਡੇ ਇੱਧਰ ਚਲੇ ਜਾਓ ਜੀ ਆਪਣੇ ਰਾਜਪੁਰੇ ਸਾਈਡ ਚਲੇ ਜਾਂਦੇ ਇਹਨਾਂ ਦੀ ਬੋਲੀ ਦਾ ਵੀ ਉੱਧਰ ਬੋਲੂਗੇ ਜੀ ਮਾਰੇ ਥਾਰੇ ਜੇ ਕਰ ਕੇ ਅਤੇ ਅਸਾ ਸਭ ਨਾਲ਼ੋਂ ਸਭ ਦੀ ਬੋਲੀ ਹਰ ਕਿਸੇ ਨੂੰ ਆਪਣੀ ਬੋਲੀ ਪਿਆਰੀ ਲੱਗਦੀ ਹੈ ਵੱਖ ਵੱਖ ਥਾਵਾਂ ਦੀ ਵੱਖ ਵੱਖ ਹੀ ਬੋਲੀ ਹੈ ਅਤੇ ਆਪਾਂ ਨੂੰ ਇਹਨਾਂ ਬੋਲੀਆਂ ਦਾ ਆਦਰ ਮਾਣ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ